ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਕਾਫ਼ੀ ਮੁੱਖ ਸੱਭਿਆਚਾਰਕ ਅੰਤਰ ਹਨ ਜਿਵੇਂ ਕਿ ਉਨ੍ਹਾਂ ਦੀ ਭਾਸ਼ਾ ਅਤੇ ਸਾਡੀ ਭਾਸ਼ਾ ਵਿੱਚ ਅੰਤਰ ਹਨ ਉਨ੍ਹਾਂ ਦੇ ਇਲਾਕੇ ਵਿੱਚ ਕੁਝ ਹੋਰ ਭਾਸ਼ਾ ਬੋਲੀ ਜਾਂਦੀ ਹੈ ਅਤੇ ਸਾਡੇ ਇਲਾਕੇ ਵਿੱਚ ਕੁਝ ਹੋਰ ਭਾਸ਼ਾ ਬੋਲੀ ਜਾਂਦੀ ਹੈ ਜੇਕਰ ਇਹ ਦੋਨੇਂ ਲੋਕ ਇਕੱਠੇ ਹੋਣ ਅਤੇ ਇੱਕ ਦੂਜੇ ਨਾਲ ਗੱਲ ਬਾਤ ਕਰਨਾ ਚਾਹੁੰਣ ਤਾਂ ਇਹ ਜੇ ਇਨ੍ਹਾਂ ਨੂੰ ਇੱਕ ਦੂਜੇ ਦੀ ਭਾਸ਼ਾ ਦੀ ਸਮਝ ਹੋਵੇਗੀ ਤਾਂ ਹੀ ਇਹ ਆਪਸ ਵਿੱਚ ਗੱਲ ਬਾਤ ਕਰ ਸਕਦੇ ਹਨ ਉੱਤਰੀ ਭਾਰ ਭਾਰਤ ਅਤੇ ਦੱਖਣੀ ਭਾਰਤ ਇਹ ਦੋਨੋਂ ਅਲੱਗ ਅਲੱਗ ਏਰੀਆ ਹਨ ਇਨ੍ਹਾਂ ਵਿੱਚ ਇਕੱਲਾ ਭ ਭਾਸ਼ਾ ਦਾ ਹੀ ਨਹੀਂ ਬਲਕੀ ਭੋਸ਼ ਭੋਜਨ ਕੱਪੜੇ ਮੌਸਮ ਰਾਜਨੀਤੀ ਸਾਖਰਤਾ ਭੂਗੋਲ ਮੌਕੇ ਆਦਿ ਦਾ ਕਾਫ਼ੀ ਫਰਕ ਹੈ ਉਹਨਾਂ ਲੋਕਾਂ ਦੇ ਪਹਿਰਾਵੇ ਅਲੱਗ ਹਨ ਭੋਜਨ ਅਲੱਗ ਹਨ ਮੌਸਮ ਅਲੱਗ ਹਨ ਉਨ੍ਹਾਂ ਦੇ ਤਿਉਹਾਰ ਅਲੱਗ ਹਨ ਅਤੇ ਸਾਡੇ ਉਨ੍ਹਾਂ ਤੋਂ ਅਲੱਗ ਹਨ ਉਹ ਉਨ੍ਹਾਂ ਦੀ ਭਾਸ਼ਾ ਜਿਵੇਂ ਤੈਲਗੂ ਤਾਮਿਲ ਆਦਿ ਹਨ ਸਾਡੀ ਭਾਸ਼ਾ ਦੁਆਬੀ ਵਰਗੇ ਇਲਾਕਿਆਂ ਦੀ ਦੁਆਬੀ ਵਰਗੇ ਇਲਾਕਿਆਂ ਦੀ ਮਾਝੀ ਹੈ ਅਤੇ ਹੋਰ ਵੀ ਭਾਸ਼ਾਵਾਂ ਹਨ ਉਨ੍ਹਾਂ ਦਾ ਭੋਜਨ ਜਿਵੇਂ ਕਿ ਜ਼ਿਆਦਾਤਰ ਮਸ਼ਹੂਰ ਉਹਨਾਂ ਦੇ ਇਲਾਕੇ ਵਿੱਚ ਹੈ ਸਾਡਾ ਸਾਡੇ ਇਲਾਕੇ ਵਿੱਚ ਮਸ਼ਹੂਰ ਹੈ ਪਰ ਸਾਨੂੰ ਦੋਨਾਂ ਸਾਨੂੰ ਜਿਵੇਂ ਆਪਾਂ ਦੱਖਣੀ ਭਾਰਤ ਵਿੱਚ ਰਹਿ ਰਹੇ ਹਾਂ ਤਾਂ ਸਾਨੂੰ ਉੱਤਰੀ ਭਾਰਤ ਦੇ ਲੋਕਾਂ ਦਾ ਭਾਸ਼ਾ ਭੋਜਨ ਕੱਪੜੇ ਅਤੇ ਹਰ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ